ਸਤਿ ਸ਼੍ਰੀ ਅਕਾਲ ਜੀ ਮੈਂ ਬਾਵਿਕਾ ਜ਼ਿਲ੍ਹਾ ਨਿਵਾਸੀ ਪਠਾਨਕੋਟ ਤੋਂ ਬੋਲ ਰਹੀ ਹਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਮੈਨੂੰ ਸਿਲਾਈ ਬੁਣਾਈ ਦਾ ਬਹੁਤ ਸ਼ੌਕ ਹੈ ਮੈਂ ਇਸ ਵਿੱਚ ਹੀ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹਾਂ ਜਿਵੇਂ ਕਿ ਮੈਂ ਪਲੱਸ ਟੂ ਦੀ ਪੜ੍ਹਾਈ ਪੂਰੀ ਕਰ ਚੁੱਕੀ ਹੋ ਕਰ ਲਈ ਹੈ ਅਤੇ ਮੈਂ ਇਸ ਇਹ ਸੋਚ ਰਹੀ ਸੀ ਕਿ ਮੈਂ ਇਹ ਸਿਲਾਈ ਬੁਣਾਈ ਨੂੰ ਆਪਣਾ ਸਾਈਡ ਬਿਜਨੈਸ ਬਣਾ ਲਵਾਂ ਇਸ ਤੋਂ ਇਸ ਦੇ ਨਾਲ ਨਾਲ ਮੈਂ ਆਪਣੀ ਅਗਲੀ ਪੜ੍ਹਾਈ ਵੀ ਜ਼ਾਰੀ ਰੱਖਾਂਗੀ ਵੈਸੇ ਤਾਂ ਮੇਰੇ ਕੋਲ ਕੱਪੜੇ ਸਿਊਣ ਲਈ ਹੱਥ ਵਾਲੀ ਮਸ਼ੀਨ ਹੈ ਪਰ ਜਿਵੇਂ ਜਿਵੇਂ ਮੇਰਾ ਕੰਮ ਵੱਧ ਰਿਹਾ ਹੈ ਮੈਂ ਇਹ ਸੋਚ ਰਹੀ ਹਾਂ ਕਿ ਮੈਂ ਪੈਰਾਂ ਵਾਲੀ ਮਸ਼ੀਨ ਜਾਂ ਇਲੈਕਟ੍ਰੋਨਿਕ ਮਸ਼ੀਨ ਲੈ ਲਵਾਂ ਜਿਸ ਨਾਲ ਮੈਂ ਆਪਣਾ ਕੰਮ ਆਸਾਨੀ ਨਾਲ ਕਰ ਸਕਾਂ ਧੰਨਵਾਦ